ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਵਧੀਆ ਭਾਅ ਜੀ ਤੁਸੀਂ ਦੱਸੋ ਅੱਛਾ ਮੈਂ ਭਾਅ ਜੀ ਅਭਿਸ਼ੇਕ ਬੋਲਦਾ ਸੀ ਤੁਸੀਂ ਚਰਨ ਬੋਲਦੇ ਹੋ ਭਾਅ ਜੀ ਮੈਂ ਹੁਸ਼ਿਆਰਪੁਰ 'ਚ ਕਾਲਜਾ ਬਾਰੇ ਪੁੱਛਣਾ ਸੀਗਾ ਵਧੀਆ ਕਾਲਜ ਕਿਹੜੇ ਕਿਹੜੇ ਆ ਦੱਸਿਓ ਕਿਹੜੇ ਕਿਹੜੇ ਕਾਲਜ ਆ ਪਹਿਲਾਂ ਸਰਕਾਰੀ ਦੱਸ ਦੋ ਕਿਹੜੇ ਕਿਹੜੇ ਆ ਵਧੀਆ ਬੀਕੌਮ ਅੱਛਾ ਇਹਨਾਂ ਦੀ ਫੀਸ ਕਿੰਨੀ ਹੋਗੀ ਭਾਅ ਜੀ ਅੱਛਾ ਡੀ ਏ ਵੀ ਕਾਲਜ ਕਿੱਧਰ ਹੈ ਕਿੱਧਰ ਭਾਅ ਜੀ ਤੇ ਐਸ ਡੀ ਕਾਲਜ ਅੱਛਾ ਤੇ ਗੋਰਮੈਂਟ ਕੋਲਜ ਠੀਕ ਹੈ ਤੇ ਪ੍ਰਾਈਵੇਟ ਪ੍ਰਾਈਵੇਟ ਕਿਹੜੇ ਕਿਹੜੇ ਕਾਲਜ ਆ ਹਾਂ ਹਾਂ ਹਾਂਜੀ ਤੇ ਇਹਨਾਂ ਦੀ ਫੀਸ ਕਿੰਨੀ ਹੈ ਅੱਛਾ ਇਹਨਾਂ ਹੋਸਟਲ ਵੀ ਹੈ ਭਾਅ ਜੀ ਅੱਛਾ ਉਹ ਕਿੱਥੇ ਕ ਹੋਣੇ ਇਹਦੇ ਨਾਲ ਹੀ ਆ ਕਿ ਦੂਰ ਦੇ ਥੋੜੇ ਬਹੁਤ ਰਿਆਤ ਰਿਆਤ ਬਾਹਰਾ ਹੈ ਕਿੱਥੇ ਭਾਅ ਜੀ ਵੈਸੇ ਤੇ ਇੰਜੀਨੀਅਰਿੰਗ ਕਾਲਜ ਕਿਹੜਾ ਵਾ ਭਾਅ ਜੀ ਹੁਸ਼ਿਆਰਪੁਰ 'ਚ ਕੋਈ ਸਰਕਾਰੀ ਸਰਕਾਰੀ ਵਿੱਚ ਕਿਹੜੇ ਕਿਹੜੇ ਆ ਗੌਰਮੈਂਟ ਗੌਰਮੈਂਟ ਕਾਲਜ ਵਾਲੇ ਨਹੀਂ ਹੈਗੇ ਸਰਵਾਨੰਦ ਕੋਈ ਹੋਸਟਲ ਹੈਗਾ ਭਾਅ ਜੀ ਪ੍ਰਾਈਜ ਕਿੰਨਾ ਹੋਗਾ ਹੋਸਟਲ ਦਾ ਅੱਛਾ ਅੱਛਾ ਸਰਵਾਨੰਦ ਫੀਸ ਕਿੰਨੀ ਹੋਊਗੀ ਭਾਅ ਜੀ ਠੀਕ ਹੈ ਠੀਕ ਤੁਸੀਂ ਤੁਸੀਂ ਤੁਸੀਂ ਵੈਸੇ ਕਿੱਥੋਂ ਕੀਤੀ ਆ ਅੱਛਾ ਉੱਥੋਂ ਕੀਤੀ ਹੈ ਉਹ ਵਧੀਆ ਭਾਅ ਜੀ ਸਭ ਤੋਂ ਵਧੀਆ ਕਿਹੜਾ ਵੈਸੇ ਤੁਹਾਡੇ ਹਿਸਾਬ ਨਾਲ ਠੀਕ ਹੈ ਠੀਕ ਹੈ ਬਸ ਚਲੋ ਠੀਕ ਆ ਭਾਅ ਜੀ ਥੈਂਕਯੂ ਥੈਂਕਯੂ